ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਹੋਰ ਕਿਆ ਹਾਲ ਚਾਲ ਹੈ ਵਧੀਆ ਜੀ ਹੋਰ ਜੋਗਿੰਦਰ ਸਿੰਘ ਬੋਲ ਰਹੇ ਹੋਰ ਠੀਕ ਹੋ ਘਰ ਪਰਿਵਾਰ ਮੈਂ ਹਰਮਿੰਦਰ ਸਿੰਘ ਬੋਲਦਾਂ ਕਪੂਰਥਲੇ ਤੋਂ ਹੋਰ ਕਿੱਦਾਂ ਚੱਲਦਾ ਕੰਮ ਕਾਰ ਸਰ ਤੁਹਾਨੂੰ ਜਿਵੇਂ ਦੱਸਿਆ ਤਾ ਵੀ ਜਿੱਦਾਂ ਮੈਂ ਅਸੀਂ ਦਿਵਾਲੀ 'ਤੇ ਅਮਰੀਕਾ ਜਾਣ ਦਾ ਪਲੈਨ ਆਪਣਾ ਬਣਾ ਰਹੇ ਵੀ ਜਿੱਦਾਂ ਮੇਰੀ ਫੈਮਿਲੀ ਪਹਿਲਾਂ ਉੱਥੇ ਹੀ ਹੈ ਫਿਰ ਮੈਂ ਸੋਚਿਆ ਵੀ ਉੱਥੇ ਘੁੰਮ ਆ ਆਈਏ ਤੁਹਾਨੂੰ ਦੱਸਿਆ ਤਾ ਵੀ ਜੇ ਇਹ ਦਾ ਇਨਕਮ ਟੈਕਸ ਰਿਟਰਨਾਂ ਬਾਰੇ ਦੱਸਿਆ ਤਾ ਵੀ ਕਿ ਕਿਆ ਕਿਆ ਪ੍ਰੋਸੈਸ ਹੈ ਵੀ ਕਿੱਥੇ ਆਉਣਾ ਚਾਹੀਦਾ ਕਪੂਰਥਲਾ ਦੇ ਵਿੱਚ ਹੋਣਾ ਹੋਇਆ ਸਰਕਾਰੀ ਦਫ਼ਤਰ 'ਚ ਤਾਂ ਦੱਸਿਓ ਸਾਨੂੰ ਵੀ ਉੱਥੇ ਕਿਆ ਪ੍ਰੋਸੈਸ ਹੈ ਕਿੱਦਾਂ ਏ ਫਿਰ ਆਪਾਂ ਜਾ ਕੇ ਕਰ ਕਰਵਾ ਲਿਆਵਾਂਗੇ ਨਹੀਂ ਤੁਸੀਂ ਦੱਸ ਦਿਉ ਵੀ ਹੁੰ ਜੋ ਜੋ ਵੀ ਚਾਹੀਦਾ ਹੋਇਆ ਮੈਂ ਤੁਹਾਨੂੰ ਮੈਂ ਦੱਸ ਦਊਂਗਾ ਠੀਕ ਹੈ ਦੱਸ ਦਿਓ ਮੈਨੂੰ ਜੋ ਜੋ ਵੀ ਚਾਹੀਦਾ ਹੋਇਆ ਜਿਹੜਾ ਵੀ ਕਾਗਜ਼ ਪੱਤਰ ਚਾਹੀਦਾ ਹੋਇਆ ਇਨਕਮ ਟੈਕਸ ਰਿਟਰਨਾਂ ਵਾਸਤੇ ਉਹ ਮੈਂ ਤੁਹਾਨੂੰ ਉਪਲਬਧ ਕਰਵਾ ਦਊਂਗਾ